ਸਰਦੀਆਂ ਦਾ ਮੌਸਮ ਹੋਵੇ ਅਤੇ ਪੰਜਾਬ ਦੇ ਕਿਸੇ ਘਰ ਵਿੱਚ ਸਾਗ ਨਾ ਬਣੇ ਇਹ ਤਾਂ ਹੋ ਹੀ ਨਹੀਂ ਸਕਦਾ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਇੱਕ ਮਿਲਗੋਬਾ ਹੈ ਜੋ ਕਿ ਪੰਜਾਬ ਦੀ ਪਹਿਚਾਣ ਹੈ ਸਾਗ ਜਿੰਨਾ ਖਾਣ ਵਿੱਚ ਸਵਾਦ ਹੈ ਉੰਨਾ ਹੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਸਾਗ ਵਿੱਚ ਫਾਈਬਰ ਕੈਲਰੀਜ ਲੋਅ ਕੈਲਰੀਜ ਕਾਰਬੋਹਾਈਡਰੇਟ ਪੋਟਾਸ਼ੀਅਮ ਵਿਟਾਮਿਨ ਏ ਸੀ ਡੀ ਬੀ ਟਵੈਲਵ ਮੈਗਨੀਸ਼ੀਅਮ ਆਇਰਨ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਸਾਗ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਵਾਧਾ ਹੁੰਦਾ ਹੈ ਅਤੇ ਅੱਖਾਂ ਦੀਆਂ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਵੀ ਨਿਜਾਤ ਦਿਵਾਉਂਦਾ ਹੈ ਪੁਰਾਣੇ ਸਮੇਂ ਦੇ ਲੋਕ ਆਪਣੀ ਇਸ ਦੇਸੀ ਖੁਰਾਕ ਕਾਰਨ ਅੱਖਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਸਨ ਸਾਗ ਖਾਣ ਨਾਲ ਬਲੈਡਰ ਪੇਟ ਬਰੈਸਟ ਅਤੇ ਫੇਫੜੇ ਦੇ ਕੈਂਸਰ ਤੋਂ ਬਚਾ ਹੁੰਦਾ ਹੈ ਗੁਣਾਂ ਨਾਲ ਭਰਪੂਰ ਹੋਣ ਕਾਰਣ ਇਹ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ ਸਾਗ ਖਾਣ ਨਾਲ ਕਲੋਸਟ੍ਰੋਲ ਵੀ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਘੱਟ ਰਹ ਘੱਟ ਬਣਿਆ ਰਹਿੰਦਾ ਹੈ ਇਸ ਤੋਂ ਇਲਾਵਾ ਸਾਗ ਭਾਰ ਘਟਾਉਣ ਗਠੀਆ ਡਿਪਰੈਸ਼ਨ ਝੁਰੜੀਆਂ ਤੋਂ ਬਚਾ ਅਤੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇੱਕ ਹੋਰ ਗੱਲ ਵੀ ਹੈ ਕਿ ਸਾਗ ਵਿੱਚ ਹਮੇਸ਼ਾ ਘਿਓ ਜਾਂ ਮੱਖਣ ਪਾ ਕੇ ਸੇਵਨ ਕਰਨਾ ਚਾਹੀਦਾ ਹੈ ਬਿਨਾਂ ਘਿਓ ਜਾਂ ਮੱਖਣ ਦੇ ਸਰੋਂ ਦਾ ਸਾਗ ਖਾਣ ਨਾਲ ਗੈਸ ਦੀ ਪਰੇਸ਼ਾਨੀ ਜਾਂ ਪਾਚਨ ਕਿਰਿਆ ਵਿੱਚ ਸਬੰਧੀ ਕੋਈ ਮ ਮੁਸ਼ਕਿਲ ਹੋ ਸਕਦੀ ਹੈ ਇਸ ਤੋਂ ਇਲਾਵਾ ਸਰੋਂ ਦੇ ਬੀਜਾਂ ਤੋਂ ਤਿਆਰ ਸਰੋਂ ਦਾ ਤੇਲ ਵੀ ਖਾਣਾ ਬਣਾਉਣ ਵਿੱਚ ਬਹੁਤ ਲਾਭਦਾਇਕ ਹੁੰਦਾ ਹੈ ਇਸ ਲਈ ਅਸੀਂ ਸਭ ਸਰਦੀਆਂ ਵਿੱਚ ਸਾਗ ਅਤੇ ਮੱਕੀ ਦੀ ਰੋਟੀ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਦੇ ਹਾਂ

ਇਹ ਸਿਹਤ ਲਈ ਬਹੁਤ ਫ਼ਇਦੇਮੰਦ ਹੈ